ਮੈਂ ਚਿੱਤਰ ਤਾਂ ਕਈ ਬਣਾਏ ਹਨ ਪਰ ਕਦੇ ਕੋਈ ਐਸੀ ਚੀਜ਼ ਨਹੀਂ ਬਣਾਈ ਜਿਸ ਨੂੰ ਬਣਾਉਣ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਹੋਵੇ ਕਿ ਇਸਦਾ ਕੋਈ ਡੂੰਘਾ ਅਰਥ ਜਾਂ ਮਹੱਤਵ ਹੈ ਕਿਉਂਕਿ ਮੈਂ ਹਰ ਵਾਰੀ ਇਹੀ ਕੋਸ਼ਿਸ਼ ਕਰਦੀ ਹਾਂ ਕਿ ਅਰਥ ਭਰਪੂਰ ਹੀ ਚਿੱਤਰ ਬਣਾਵਾਂ